ਜੇਕਰ ਆਧੁਨਿਕ ਤਕਨੀਕ ਨਾਲ ਕਿਸੇ ਵੀ ਯੁੱਗ 'ਤੇ ਯਾਤਰਾ ਕਰਨੀ ਹੋਵੇ ਤਾਂ ਮੈਂ ਫਿਊਚਰ ਵਿੱਚ ਯਾਤਰਾ ਕਰਨਾ ਚਾਹਵਾਂਗਾ ਜਿਸ ਦੇ ਨਾਲ ਉੱਥੋਂ ਉਹਦੇ ਆਰਟੀਫਿਸ਼ਅਲ ਇੰਟੈਲੀਜਸ ਤਕਨੀਕ ਨੂੰ ਮਿਟਾਉਣ ਲਈ ਜਿਹੜੇ ਵੀ ਉਪਕਰਣ ਲੱਗਦੇ ਹੋਣ ਮੈਂ ਉਹ ਵਾਪਿਸ ਆਪਣੇ ਇਸ ਯੁੱਗ ਦੇ ਨਾਲ ਲੈ ਕੇ ਆਵਾਂਗਾ ਕਿਉਂਕਿ ਆਰਟੀਫਿਸ਼ਅਲ ਇੰਟੈਲੀਜੈਂਸ ਇੱਕ ਬਹੁਤ ਹੀ ਭਿਆਨਕ ਤਕਨੀਕ ਹੈ ਜਿਸ ਦੇ ਨਾਲ ਕਿਸੇ ਦੀ ਵੀ ਆਵਾਜ਼ ਕਿਸੇ ਦਾ ਵੀ ਚਿਹਰਾ ਕਿਸੀ ਦੇ ਵੀ ਹਾਵ ਭਾਵ ਬਦਲੇ ਜਾ ਸਕਦੇ ਨੇ ਜਿਸ ਦੇ ਨਾਲ ਅੱਜ ਦੀ ਦੁ ਯੁੱਗ ਵਿੱਚ ਪਰਮ ਅਸ਼ਾਂਤੀ ਅਤੇ ਬੈ ਨੁਕਸਾਨ ਹਰ ਵੇਲੇ ਕਾਇਮ ਰਹਿੰਦਾ ਹੈ ਕਿਸੇ ਦੇ ਨਾਲ ਵੀ ਧੋਖਾਧੜੀ ਵਾਸਤੇ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਵਰਤਿਆ ਜਾ ਸਕਦਾ ਹੈ ਕਿਸੇ ਦੇ ਨਾਲ ਵੀ ਕਿਸੇ ਕਿਸਮ ਦਾ ਫਰਾਡ ਕਰਨ ਵਾਸਤੇ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਵਰਤਿਆ ਜਾ ਰਿਹਾ ਹੈ ਇਸ ਲਈ ਮੈਂ ਉਸ ਯੁੱਗ ਤੋਂ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਸਮਾਪਤ ਕਰਨ ਵਾਸਤੇ ਜਿਹੜੀ ਵੀ ਟੈਕਨੀਕ ਉਹਨਾਂ ਨੇ ਬਣਾਈ ਹੋਵੇਗੀ ਮੈਂ ਉਹ ਟੈਕਨੀਕ ਇਸ ਯੁੱਗ ਤੋਂ ਲੈ ਕੇ ਆਣ ਆਉਣਾ ਚਾਹਵਾਂਗਾ ਤਾਂ ਕਿ ਇਸ ਯੁੱਗ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਮਿਟਾ ਸਕਾਂ ਉਸ ਨੂੰ ਸੁਧਾਰ ਕਰ ਸਕਾਂ ਅਤੇ ਮੁੜ ਨੋਰਮਲ ਜ਼ਿੰਦਗੀ ਨੋਰਮਲ ਸੱਭਿਆਚਾਰਕ ਆਪਣੀ ਜ਼ਿੰਦਗੀ ਨੂੰ ਬਣਾਇਆ ਜਾ ਸਕੇ ਇਸ ਤਰ੍ਹਾਂ ਦੀ ਵਰਤੋਂ ਕੀਤੀ ਜਾ ਸਕੇ ਅਸੀਂ ਆਰਟੀਫਿਸ਼ਅਲ ਇੰਟੈਲੀਜੈਂਸ ਨੂੰ ਵੀ ਇੱਕ ਸੱਭਿਆਚਾਰਕ ਰੂਪ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ ਅੱਜ ਦੇ ਯੁੱਗ ਵਿੱਚ ਆਰਟੀਫਿਸ਼ਅਲ ਇੰਟੈਲੀਜੈਂਸ ਬਹੁਤ ਹੀ ਮਾੜਾ ਭਰਮ ਬਣ ਚੁੱਕਾ ਹੈ ਜੋ ਕਿ ਇਸ ਨੂੰ ਸਮਾਪਤ ਕਰਨਾ ਬਹੁਤ ਜ਼ਰੂਰੀ ਹੈ